ਡਾਂਸ ਕਰਕੇ ਸਿਰਫ ਦਿਲ ਹੀ ਖੁਸ਼ ਨਹੀਂ ਹੁੰਦਾ ਸਗੋਂ ਤੁਸੀਂ ਫਿੱਟ ਵੀ ਰਹਿੰਦੇ ਹੋ ਜੇਕਰ ਤੁਸੀਂ ਰੋਜ਼ਾਨਾ ਥੋੜ੍ਹੀ ਦੇਰ ਤੱਕ ਡਾਂਸ ਕਰਦੇ ਹੋ ਤਾਂ ਮੂਡ ਤਾਜ਼ਾ ਦਿਲ ਸਿਹਤਮੰਦ ਭਾਰ ਅਤੇ ਤਣਾਅ ਨੂੰ ਵੀ ਘੱਟ ਕਰਨ 'ਚ ਮਦਦ ਮਿਲਦੀ ਹੈ ਜੇਕਰ ਤੁਸੀਂ ਕੋਈ ਕਸਰਤ ਨਹੀਂ ਕਰਦੇ ਤਾਂ ਪੰਦਰ੍ਹਾਂ ਤੋਂ ਵੀਹ ਮਿੰਟ ਤੱਕ ਡਾਂਸ ਕਰ ਸਕਦੇ ਹੋ ਡਾਂਸ ਕਰਨ ਨਾਲ ਪੂਰਾ ਸਰੀਰ ਐਕਟਿਵ ਹੋ ਜਾਂਦਾ ਹੈ ਅਤੇ ਤਣਾਅ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ ਡਾਂਸ ਕਰਨ ਨਾਲ ਸਿਹਤ ਨੂੰ ਕਈ ਤਰ੍ਹਾਂ ਦੇ ਲਾਭ ਮਿਲਦੇ ਹਨ ਮੋਟਾਪਾ ਘਟਾਉਣ ਵਿੱਚ ਮਦਦਗਾਰ ਡਾਂਸ ਕਰਨ ਨਾਲ ਫੈਟ ਤੇਜ਼ੀ ਨਾਲ ਘੱਟ ਹੁੰਦਾ ਹੈ ਜੇਕਰ ਤੁਸੀਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਡਾਂਸ ਕਰ ਸਕਦੇ ਹੋ ਜਿਵੇਂ ਜੁੰਬਾ ਬੈਲੇ ਕਲਾਸੀਕਲ ਹਿਪ ਹੋਪ ਵਰਗੇ ਡਾਂਸ ਕਰਨ ਨਾਲ ਮੋਟਾਪੇ ਨੂੰ ਘੱਟ ਕੀਤਾ ਜਾ ਸਕਦਾ ਹੈ ਹੱਡੀਆਂ ਨੂੰ ਮਜ਼ਬੂਤ ਡਾਂਸ ਕਰਨ ਨਾਲ ਸਰੀਰ 'ਚ ਲਚਕੀਲਾਪਣ ਆਉਂਦਾ ਹੈ ਅਤੇ ਹੱਡੀਆਂ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਐਨਰਜੀ ਡਾਂਸ ਕਰਨ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ ਅਤੇ ਥਕਾਵਟ ਦੀ ਸਮੱਸਿਆ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ ਦਿਮਾਗ ਤੇਜ਼ ਹੁੰਦਾ ਹੈ ਡਾਂਸ ਕਰਕੇ ਸਰੀਰ ਦੇ ਨਾਲ ਨਾਲ ਦਿਮਾਗ ਨੂੰ ਐਕਟਿਵ ਅਤੇ ਸਿਹਤਮੰਦ ਰੱਖਣ ਵਿੱਚ ਮਦਦ ਮਿਲਦੀ ਹੈ ਇਸ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ ਇਸ ਤਰ੍ਹਾਂ ਕਈ ਖੋਜਾਂ ਵਿੱਚ ਪਾਇਆ ਗਿਆ ਹੈ ਕਿ ਡਾਂਸ ਕਰਨ ਨਾਲ ਦਿਮਾਗੀ ਕਮਜ਼ੋਰੀ ਦੇ ਲੱਛਣਾਂ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ ਬਲੱਡ ਸਰਕੂਲੇਸ਼ਨ ਡਾਂਸ ਕਰਨਾ ਸਰੀਰ 'ਚ ਬਲੱਡ ਸੈਲਕੂਰੇਸ਼ਨ ਵਿੱਚ ਸੁਧਾਰ ਹੁੰਦਾ ਹੈ ਬਲੱਡ ਸਰਕੂਲੇਸ਼ਨ ਸਰੀਰ ਦੇ ਕਈ ਅੰਗਾਂ ਨੂੰ ਜਿਵੇਂ ਸੁਚਾਰੂ ਢੰਗ ਨਾਲ ਕੰਮ ਕਰਨ ਲਈ ਜ਼ਰੂਰੀ ਹੁੰਦਾ ਹੈ ਇਸ ਤਰ੍ਹਾਂ ਡਾਂਸ ਕਰਕੇ ਅਸੀਂ ਆਪਣੀ ਸਿਹਤ ਨੂੰ ਚੰਗੀ ਕਰ ਸਕਦੇ ਹਾਂ